ਹੈਲੋ ਹਾਂ ਪਰਮ ਕੀ ਹਾਲ ਈ ਬਸ ਬਸ ਤੂੰ ਦੱਸ ਕੀ ਕਰਦੀ ਪਈ ਆ ਅੱਛਾ ਤੂੰ ਪਲੱਸ ਟੂ ਮੈਡੀਕਲ 'ਚ ਕੀਤੀ ਹੀ ਨਾ ਯਾਰ ਆਪਣੇ ਜਿਹੜਾ ਇੱਥੇ ਮਜੀਠੀਵਾਲ ਜਿਹੜਾ ਗੌਰਮੈਂਟ ਮੈਡੀਕਲ ਕੋਲਜ ਹੈਗਾ ਆ ਉੱਥੇ ਵੇਖ ਲਾ ਤੂੰ ਉੱਥੇ ਰਿਸੈਪਸ਼ਨ 'ਤੇ ਜਾਈਂ ਠੀਕ ਹੈ ਉੱਥੇ ਤੈਨੂੰ ਸਭ ਉਹਨਾਂ ਨੇ ਦੱਸ ਦੇਣਾ ਕਿ ਕਿਸ ਤਰ੍ਹਾਂ ਹੈਗਾ ਆ ਹਾਂ ਉਹਨਾਂ ਨੇ ਤੈਨੂੰ ਫੀਸ ਸਟੱਕਚਰ ਬਾਰੇ ਵੀ ਸਭ ਕੁਛ ਦੱਸ ਦੇਣਾ ਕਿ ਕਿਸ ਤਰ੍ਹਾਂ ਫੀਸ ਦੇਣੀ ਆ ਅਤੇ ਕੀ ਕੀ ਇੱਥੇ ਹੈਗਾ ਆ ਆਹੋ ਚੱਲ ਜੇ ਫਿਰ ਤੈਨੂੰ ਫਿਰ ਵੀ ਜ਼ਿਆਦਾ ਦਿੱਕਤ ਆਵੇਗੀ ਕੋਈ ਗੱਲ ਨਹੀਂ ਤੂੰ ਮੈਂ ਤੇਰੇ ਨਾਲ ਚੱਲ ਪੂੰਗੀ ਆਪਾਂ ਦੋਵੇਂ ਚੱਲ ਜਾਂਗੇ ਆਪਾਂ ਦੋਵਾਂ ਵੇਖ ਲਾਂਗੇ ਆਹੋ ਆਹੋ ਤੂੰ ਆਜੀ ਮੇਰੇ ਤੋਂ ਕੱਲ੍ਹ ਅਤੇ ਆਪਾਂ ਕੱਲ੍ਹ ਮਿਲਦੇ ਹਾਂ ਫਿਰ ਅਤੇ ਚਲ ਜਾਂਗੇ ਅਤੇ ਤੇਰਾ ਕੰਮ ਕਰ ਦਾਂਗੇ ਚਲ ਫਿਰ ਠੀਕ ਹੈ ਮਿਲਦੇ ਹਾਂ ਕੱਲ੍ਹ ਓਕੇ ਬਾਏ ਹਾਂ ਓਕੇ ਥੈਂਕ ਯੂ